ਭਾਰਤ ਵਿੱਚ ਖ਼ਾਸ ਕਰਕੇ ਪੰਜਾਬ ਵਿੱਚ ਲੋਹੜੀ ਦਾ ਤਿਉਹਾਰ ਬਹੁਤ ਮਹੱਤਵਪੂਰਨ ਹੈ ਇਸ ਇਹ ਜਨਵਰੀ ਮਹੀਨੇ ਵਿੱਚ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ਅਤੇ ਇਹ ਇਸ ਮਾਨਤਾ ਹੈ ਕਿ ਇਸ ਤੋਂ ਬਾਅਦ ਠੰਡ ਆਪਣੇ ਆਖਰੀ ਪੜਾਅ ਵਿੱਚ ਪਹੁੰਚ ਜਾਂਦੀ ਹੈ ਅਤੇ ਇਸ ਨੂੰ ਮਨਾਉਣ ਲਈ ਰਾਤ ਨੂੰ ਧੂਣੀ ਜਲਾਈ ਜਾਂਦੀ ਹੈ ਅਤੇ ਜਿਸ ਵਿੱਚ ਅਨਾਜ ਵਗੈਰਾ ਦੀ ਆਹੂਤੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਵਿਸਾਖੀ ਦਾ ਤਿਉਹਾਰ ਵੀ ਖ਼ਾਸ ਮਹੱਤਵ ਰੱਖਦਾ ਹੈ ਇਸ ਇਹ ਫ਼ਸਲਾਂ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਪ ਪੰਜਾਬੀ ਲੋਕ ਕ ਕਣਕ ਦੀ ਵਾਢੀ ਕਰਕੇ ਅ ਮੇਲੇ ਵਿੱਚ ਆਉਂਦੇ ਹਨ ਅਤੇ ਉੱਥੇ ਭੰਗੜੇ ਵਗੈਰਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ ਉਹਨਾਂ ਮੇਲੇ ਵਿੱਚੋਂ ਖ਼ਾਸ ਚੀਜ਼ਾਂ ਖਰੀਦਦੇ ਹਨ ਕਿਉਂਕਿ ਕਣਕ ਦੀ ਵਾਢੀ ਕਰਕੇ ਉਹਨਾਂ ਕੋਲ ਪੈਸੇ ਕਾਫੀ ਆ ਜਾਂਦੇ ਹਨ ਇਸ ਕਰਕੇ ਉਹ ਅ ਜਿਹੜੀਆਂ ਵੀ ਜ਼ਰੂਰਤ ਦੀਆਂ ਚੀਜ਼ਾਂ ਨੇ ਨਵੇਂ ਕੱਪੜੇ ਵਗੈਰਾ ਖਰੀਦ ਕੇ ਮੇਲੇ ਵਿੱਚ ਬਹੁਤ ਖੁਸ਼ੀ ਆਨੰਦ ਮਹਿਸੂਸ ਕਰਦੇ ਹਨ ਇਹ ਦੋਨੋਂ ਤਿਉਹਾਰ ਖ਼ਾਸ ਕਰ ਪੰਜਾਬ ਖਾਸ ਕਰਕੇ ਕਿਰਸਾਨੀ ਵਿੱਚ ਇੱਕ ਬਹੁਤ ਜ਼ਿਆਦਾ ਮਹੱਤਵ ਰੱਖਦੇ ਹਨ